ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਗਗਨਦੀਪ ਸਿੰਘ ਗੱਲ ਕਰਦਾ ਜੀ ਮੈਂ ਤੁਹਾਡੇ ਲੱਕੀ ਕਮਿਊਨੀਕੇਸ਼ਨ ਤੋਂ ਲੈਪਟੋਪ ਔਡਰ ਕੀਤਾ ਸੀ ਇੱਕ ਤਾਂ ਮੈਨੂੰ ਪਹਿਲੀ ਜੋ ਲੈਪਟੋਪ ਦੀ ਡਿਲੀਵਰੀ ਹੈ ਚਾਰ ਤੋਂ ਪੰਜ ਦਿਨ ਲੇਟ ਪਹੁੰਚੀ ਹੈ ਅਤੇ ਹੁਣ ਜਦੋਂ ਮੈਂ ਲੈਪਟੋਪ ਔਨ ਕਰਨ ਲੱਗਿਆ ਇੱਕ ਤਾਂ ਇਹ ਸਟਾਰਟ ਹੋਣ ਵਿੱਚ ਇਹਨੇ ਕਾਫੀ ਟਾਈਮ ਲਿਤਾ ਅਤੇ ਦੂਜਾ ਇਹ ਕਾਫੀ ਹੈਂਗ ਹੋ ਰਿਹਾ ਹੁਣ ਸਟਾਰਟ ਹੋ ਕੇ ਅਤੇ ਇਹਦੇ ਜੋ ਕੀਬੋਰਡ ਦੇ ਸਵਿੱਚ ਹੈ ਉਹ ਵੀ ਚੰਗੇ ਨਹੀਂ ਚੱਲਦੇ ਹੈਗੇ ਹੁਣ ਤੁਸੀਂ ਦੱਸੋ ਕਿ ਜੋ ਤੁਹਾਡਾ ਸ਼ੋਪ ਦਾ ਕੋਈ ਕਰਮਚਾਰੀ ਆ ਕੇ ਇਸ ਨੂੰ ਰਿਪੇਅਰ ਕਰੇਗਾ ਜਾਂ ਮੈਂ ਦੁਕਾਨ 'ਤੇ ਆ ਕੇ ਇਹਨੂੰ ਵਾਪਸ ਮੋੜਾਂ ਕਿਉਂਕਿ ਇਹ ਚੰਗਾ ਨਹੀਂ ਚੱਲਦਾ ਹੈਗਾ ਤੁਸੀਂ ਕਰੋ ਇਹਦਾ ਕੋਈ ਇੰਤਜ਼ਾਮ ਠੀਕ ਹੈ ਜੀ ਥੈਂਕ ਯੂ